ਅਗਰ ਮੈਨੂੰ ਫੋਟੋਗ੍ਰਾਫੀ ਵਿੱਚ ਭਾਰਤ ਨੂੰ ਦਿਖਾਉਣ ਦਾ ਮੌਕਾ ਮਿਲੇ ਤਾਂ ਮੈਂ ਭਾਰਤ ਦੇ ਇਤਿਹਾਸ ਨੂੰ ਭਾਰਤ ਦੇ ਸੱਭਿਆਚਾਰ ਨੂੰ ਦਿਖਾਉਣ ਦਾ ਯਤਨ ਕਰਾਂਗਾ ਕਿਉਂਕਿ ਪ ਭਾਰਤ ਦਾ ਜੋ ਵਿਰਾਸਤ ਹੈ ਜੋ ਭਾਰਤ ਦਾ ਇਤਿਹਾਸ ਹੈ ਬਹੁਤ ਵਿਸ਼ਾਲ ਹੈ ਇਸੇ ਤਰ੍ਹਾਂ ਹੀ ਜੋ ਭਾਰਤ ਦਾ ਕਲਚਰ ਹੈ ਸੱਭਿਆਚਾਰ ਹੈ ਉਹ ਵਿਭਿੰਨ ਹੈ ਤਰ੍ਹਾਂ ਤਰ੍ਹਾਂ ਦਾ ਹੈ ਭਾਰਤ ਦੇ ਕਲਚਰ ਵਿੱਚ ਕਈ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਇਸੇ ਤਰ੍ਹਾਂ ਹੀ ਕਈ ਭਾਸ਼ਾਵਾਂ ਹੀ ਭਾਰਤ ਦੇ ਕਲਚਰ ਵਿੱਚ ਭਾਰਤ ਦੇ ਸੱਭਿਆ ਵਿੱਚ ਕਈ ਤਰ੍ਹਾਂ ਦੇ ਲੋਕ ਉਹਨਾਂ ਦੇ ਵੱਖ ਵੱਖ ਪਹਿਰਾਵੇ ਉਹਨਾਂ ਦੇ ਵੱਖ ਵੱਖ ਜੀਵਨ ਸ਼ੈਲੀਆਂ ਉਹਨਾਂ ਦੇ ਸਾਰਾ ਰਹਿਣ ਟਾ ਰਹਿਣ ਸਹਿਣ ਰਹਿਣ ਸਹਿਣ ਦੇ ਢੰਗ ਉਹ ਜੰਗਲਾਂ 'ਚ ਕਿਵੇਂ ਰਹਿੰਦੇ ਆ ਉਸ ਤਰ੍ਹਾਂ ਉਹ ਆਲੀਸ਼ਾਨ ਮਹਿਲਾਂ ਵਿੱਚ ਕਿਵੇਂ ਰਹਿੰਦੇ ਆ ਉਹਨਾਂ ਨੂੰ ਆਪਸ ਵਿੱਚ ਜੋੜ ਕੇ ਮੈਂ ਆਪਦੀ ਫੋਟੋਗ੍ਰਾਫੀ ਵਿੱਚ ਲਿਆਉਣਾ ਚਾਹੁੰਦਾ ਹਾਂ ਜਿਵੇਂ ਕਿ ਜਿਵੇਂ ਕਿ ਝਾਰਖੰਡ ਦੇ ਵਿੱਚ ਲੋਕ ਆਦੀਵਾਸੀ ਕਬੀਲਿਆਂ ਦੇ ਲੋਕ ਜੰਗਲਾਂ ਵਿੱਚ ਕਿਵੇਂ ਸਰਵਾਈਵ ਕਰਦੇ ਹਨ ਉਹਨਾਂ ਨੂੰ ਆਪਦੀ ਫੋਟੋਗ੍ਰਾਫੀ ਵਿੱਚ ਲਿਆਉਣਾ ਚਾਹੁੰਦਾ ਹਾਂ ਉਸੇ ਤਰ੍ਹਾਂ ਹੀ ਪੰਜਾਬ ਵਿੱਚ ਲੋਕ ਖੇਤਾਂ ਵਿੱਚ ਕਿਵੇਂ ਮਿਹਨਤ ਕਰਦੇ ਹਨ ਮਿਹਨਤ ਕਰਕੇ ਆਪਦੇ ਸਰੀਰ ਨਾਲ ਤਗੜੀ ਮਿਹਨਤ ਕਰਕੇ ਕਿੰਨਾਂ ਦੇਸ਼ ਨੂੰ ਰਾਸ਼ਨ ਪਹੁੰਚਾਉਂਦੇ ਹਨ ਦੇਸ਼ ਨੂੰ ਅੰਨ ਪੈਦਾ ਕਰਕੇ ਦਿਖਾਓ ਦਿੰਦੇ ਹਨ ਉਸੇ ਤਰ੍ਹਾਂ ਹੀ ਜੋ ਖਾਸ ਕਰਕੇ ਪੰਜਾਬ ਜੋ ਦੀਵਾਰ ਹੈ ਪ੍ਰਵੇਸ਼ ਦੁਆਰ ਹੈ ਕਿੰਨੇ ਇਸ 'ਤੇ ਹਮਲੇ ਹੋਏ ਆ ਉਹ ਸਾਰੇ ਹਮਲਿਆਂ ਨੂੰ ਬਿਆਨ ਕਰਦੇ ਜੋ ਇਤਿਹਾਸਿਕ ਸਥਾਨ ਹੈ ਜਿਵੇਂ ਉਹ ਹੁਸੈਨੀ ਵਾਲਾ ਬਾਰਡਰ 'ਤੇ ਜਿਵੇਂ ਜਲਿਆਂ ਵਾਲਾ ਬਾਗ ਉਹਨਾਂ ਸਾਰਿਆਂ ਨੂੰ ਆਪਦੀ ਫੋਟੋਗ੍ਰਾਫੀ ਵਿੱਚ ਦਿਖਾਉਣਾ ਚਾਹੁੰਦਾ ਹਾਂ